ਇੱਕ ਵਾਰੀ ਇਕੱਲੇ ਸਫ਼ਰ ਕਰਦੇ ਹੋਇਆਂ ਮੈਂ ਹਿਮਾਚਲ ਦਾ ਇੱਕ ਬਹੁਤ ਹੀ ਖੂਬਸੂਰਤ ਏਰੀਆ ਪਾਲਮਪੁਰ ਗਿਆ ਸੀ ਉੱਥੇ ਮੈਂ ਨੌ ਦਿਨ ਸਟੇਅ ਕੀਤਾ ਅਤੇ ਮੈਂ ਉੱਥੇ ਦੇ ਆਲੇ ਦੁਆਲੇ ਘੁੰਮਿਆ ਵਧੀਆ ਇਨਵਾਇਰਮੈਂਟ ਵਾਈਜ਼ ਪਾਲਮਪੁਰ ਬਹੁਤ ਹੀ ਵਧੀਆ ਸੀ ਪਰ ਮੈਂ ਇਕੱਲੇ ਹੋਣ ਕਾਰਨ ਬਹੁਤ ਹੀ ਬੋਰ ਹੋਇਆ ਕਿਉਂਕਿ ਉਸ ਸਮੇਂ ਦੌਰਾਨ ਮੋਬਾਇਲ ਇੰਟਰਨੈੱਟ ਦੀ ਸੇਵਾ ਘੱਟ ਸੀ ਕਿਉਂਕਿ ਇੰਟਰਨੈੱਟ ਕਨੈਕਟੀਵਿਟੀ ਥੋੜ੍ਹੀ ਲੇਟ ਪੁੱਜੀ ਹੈ ਇਹ ਗੱਲ ਬਹੁਤ ਪੁਰਾਣੀ ਹੈ ਇਸ ਵਜ੍ਹਾ ਕਰਕੇ ਮੈਂ ਥੋੜ੍ਹਾ ਜਿਹਾ ਬੋਰਿੰਗ ਵੀ ਰਿਹਾ ਉਹ ਸਫ਼ਰ ਮੇਰੇ ਲਈ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਅਸੀਂ ਉਸੇ ਜਾਈਏ ਤਾਂ ਹਰ ਚੀਜ਼ ਕਨੈਕਟੀਵਿਟੀ ਹੈ ਰੋਡ ਵਾਈਜ਼ ਵੀ ਅੱਛੇ ਨੇ ਔਰ ਹਰ ਚੀਜ਼ ਅਵੇਲੇਬਿਲਟੀ ਹੈ ਜੀ